ਪੰਛੀਆਂ ਦੀ ਮਿੱਠੀ ਮਿੱਠੀ ਬੋਲੀ ਅਤੇ ਸਵੇਰ ਦੀ ਮਿੱਠੀ ਮਿੱਠੀ ਹਵਾ ਇੰਝ ਲੱਗਦੀ ਹੈ ਜਿਵੇਂ ਦੇਸੀ ਘਿਓ ਦੀ ਰੋਟੀ ਦੇ ਨਾਲ ਗੁੜ ਦੀ ਡਲੀ ਜੇਕਰ ਦਿਨ ਦੀ ਸ਼ੁਰੂਆਤ ਹੀ ਪੰਛੀਆਂ ਦੀ ਚਹਿਚਹਾਟ ਨਾਲ ਹੋਵੇ ਤਾਂ ਦਿਨ ਵਧੀਆ ਲੰਘਦਾ ਹੈ ਪੰਛੀ ਕੁਦਰਤ ਦੀ ਵੱਡੀ ਦੇਣ ਹਨ ਅੱਜ ਕੱਲ੍ਹ ਰੇਡੀਓ ਟਾਵਰਾਂ ਦੇ ਵਿਕਸਿਤ ਹੋਣ ਕਾਰਨ ਪੰਛੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ ਰੁੱਖਾਂ ਦੀ ਕਟਾਈ ਨੇ ਵੀ ਪੰਛੀਆਂ ਦੇ ਰਹਿਣ ਸਹਿਣ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਪੰਛੀ ਖੁੱਲ੍ਹੇ ਵਿਹੜੇ ਵਿੱਚ ਚੋਗਾ ਚੁਗਣਾ ਬਹੁਤ ਪਸੰਦ ਕਰਦੇ ਹਨ ਪੰਛੀਆਂ ਨੂੰ ਚੋਗਾ ਪਾਉਣਾ ਹੀ ਪੰਛੀਆਂ ਨੂੰ ਆਕਰਸ਼ਿਤ ਕਰਨ ਦਾ ਵਧੀਆ ਢੰਗ ਹੈ ਇਸ ਤੋਂ ਇਲਾਵਾ ਅਸੀਂ ਆਪਣੇ ਬਗੀਚੇ ਵਿੱਚ ਬਣਾਉਟੀ ਆਲ੍ਹਣੇ ਲਾ ਕੇ ਵੀ ਪੰਛੀਆਂ ਨੂੰ ਆਕਰਸ਼ਿਤ ਕਰ ਸਕਦੇ ਹਾਂ ਪੰਛੀਆਂ ਨੂੰ ਅਨਾਜ ਅਤੇ ਪਾਣੀ ਰੱਖਣਾ ਬਹੁਤ ਵਧੀਆ ਗੱਲ ਹੈ ਸਾਨੂੰ ਪੰਛੀਆਂ ਲਈ ਦਾਣਾ ਅਤੇ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਫਿਰ ਚਾਹੇ ਘਰ ਦੇ ਬਗੀਚੇ ਵਿੱਚ ਹੋਵੇ ਜਾਂ ਘਰ ਦੀਆਂ ਛੱਤਾਂ 'ਤੇ